ਸਾਡੇ ਧਾਰਮਿਕ ਅਭਿਆਸਾਂ ਅਤੇ ਸੱਭਿਆਚਾਰ ਵਿੱਚ ਤਕਨੀਕੀ ਨਵੀਨਤਾਵਾਂ ਦੀ ਬਹੁਤ ਲੋੜ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀ ਨਵੀਨਤਾਵਾਂ ਆ ਚੁੱਕੀਆਂ ਹਨ ਅਤੇ ਇਹਨਾਂ ਦੀ ਬਹੁਤ ਲੋੜ ਸੀ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਪੱਧਰ ਵਿੱਚ ਨਵੀਨਤਾ ਦੀ ਲੋੜ ਹੈ ਅਤੇ ਧਾਰਮਿਕ ਅਭਿਆਸਾਂ ਵਿੱਚ ਅਤੇ ਸੱਭਿਆਚਾਰ ਵਿੱਚ ਵੀ ਇਹਨਾਂ ਦੀ ਬਹੁਤ ਸਾਰੀ ਜ਼ਰੂਰਤ ਹੈ ਮੇਰੇ ਧਾਰਮਿਕ ਅਭਿਆਸਾਂ ਵਿੱਚ ਤਕਨੀਕੀ ਨਵੀਨਤਾਵਾਂ ਨੇ ਕਈ ਸਰੋਤ ਮੁਹੱਈਆ ਕਰਵਾਇਆ ਜਿਵੇਂ ਕਿ ਆਈ ਟੀ ਆਈ ਦੇ ਸੰਬੰਧ ਨਾਲ ਸੰਬੰਧਿਤ ਮੈਂ ਮੈਂ ਪੰਜਾਬੀ ਅਧਿਆਪਕ ਹੋਣ ਦੇ ਨਾਤੇ ਗੁਰਮੁਖੀ ਦੀ ਬਹੁਤ ਜ਼ਰੂਰਤ ਸੀ ਉਸ ਵਿੱਚ ਸਰਕਾਰ ਵੱਲੋਂ ਆਈ ਟੀ ਆਈ ਨਾਲ ਸੰਬੰਧਿਤ ਕੁਛ ਅਜਿਹੇ ਉਪਕਰਨਾਂ ਦੀ ਲੋੜ ਮਹਿਸੂਸ ਹੋਈ ਜਿਹਦੇ ਨਾਲ ਸਾਨੂੰ ਪੰਜਾਬੀ ਲਿਖਣ ਵਿੱਚ ਵੀ ਬਹੁਤ ਸਾਰੇ ਸਮੱਸਿਆਵਾਂ ਆਉਂਦੀਆਂ ਸੀ ਪਰ ਅਜੋਕੇ ਸਮੇਂ ਸਮੇਂ ਵਿੱਚ ਨਵੀਨਤਾ ਹੋਣ ਕਰਕੇ ਗੁਰਮੁਖੀ ਲਿਖਣੀ ਬਹੁਤ ਸੁਖਾਲੀ ਹੋ ਗਈ ਹੈ ਫੋ ਮੋਬਾਇਲ ਫੋਨਾਂ ਵਿੱਚ ਵੀ ਅਸੀਂ ਅਸ ਬਹੁਤ ਆਸਾਨੀ ਦੇ ਨਾਲ ਪੰਜਾਬੀ ਦੀਆਂ ਸ਼ਬਦਾਵਲੀ ਵਰਤ ਸਕਦੇ ਹਾਂ ਅਤੇ ਉਹਨੂੰ ਲਿਖਤੀ ਰੂਪ ਦੇ ਸਕਦੇ ਹਾਂ ਇਸ ਕਰਕੇ ਮੈਨੂੰ ਇਹ ਸਾਰੀਆਂ ਨਵੀਨਤਾਵਾਂ ਵਿੱਚ ਬਹੁਤ ਸੁਧਾਰ ਲੱਗਾ ਮੈਂ ਅਗ ਆਉਣ ਵਾਲੇ ਸਮਾਜ ਵਿੱਚ ਵੀ ਚਾਹੁੰਦੀ ਹਾਂ ਕਿ ਇਹ ਸਾਰੀਆਂ ਤਕਨੀਕਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮੁਹੱਈਆ ਕਰਵਾਇਆ ਜਾਵੇ ਅਤੇ ਆਉਣ ਵਾਲੀ ਪੀੜੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ